ਹਾਂ ਮੈਂ ਸਕੈਚ ਦੀ ਵਰਤੋਂ ਕਰਕੇ ਪਕਵਾਨ ਬਣਾਇਆ ਸੀ ਮੈਂ ਸਭ ਤੋਂ ਪਹਿਲਾਂ ਇਹ ਪਕਵਾਨ ਯੂਟਿਊਬ ਉੱਤੇ ਦੇਖਿਆ ਪਰ ਉਸ ਵਕਤ ਮੈਨੂੰ ਇਸ ਦੀ ਬਹੁਤੀ ਸਮਝ ਨਹੀਂ ਆਈ ਫਿਰ ਇੱਕ ਦਿਨ ਮੈਂ ਬਜ਼ਾਰ ਜਾ ਕੇ ਕਾਫ਼ੀ ਮਸਾਲੇ ਅਤੇ ਸਬਜ਼ੀਆਂ ਖਰੀਦ ਕੇ ਲੈ ਕੇ ਆਈ ਮੈਂ ਬਹੁਤ ਸੋਚ ਸੋਚ ਕੇ ਲਸਣ ਅਦਰਕ ਹਰੀ ਮਿਰਚ ਭਿੰਡੀ ਅਤੇ ਤੋਰੀਆਂ ਨੂੰ ਮਸਾਲਿਆਂ ਨਾਲ ਭਰ ਕੇ ਫਰਾਈ ਕੀਤਾ ਫਿਰ ਉਸ ਤੜਕਾ ਲਾ ਕੇ ਸਕੈਚ ਦੀ ਵਰਤੋਂ ਨਾਲ ਇੱਕ ਵੱਖਰਾ ਪਕਵਾਨ ਬਣਾਇਆ ਉਸ ਦਿਨ ਹੀ ਸਾਡੇ ਘਰ ਮਹਿਮਾਨ ਆ ਗਏ ਜਦੋਂ ਅਸੀਂ ਰੋਟੀ ਖਾਣ ਲੱਗੇ ਤਾਂ ਇਹ ਡਿਸ਼ ਵੀ ਮੈਂ ਉਹਨਾਂ ਦੇ ਅੱਗੇ ਰੱਖ ਦਿੱਤੀ ਉਨ੍ਹਾਂ ਸਭ ਨੇ ਮੇਰੀ ਇਸ ਨਵੀਂ ਡਿਸ਼ ਦੀ ਬਹੁਤ ਤਰੀਫ਼ ਕੀਤੀ ਮੈਨੂੰ ਖੁਦ ਵੀ ਇਹ ਡਿਸ਼ ਖਾਣ ਵਿੱਚ ਬਹੁਤ ਸੁਆਦ ਲੱਗੀ ਉਸ ਦਿਨ ਤਾਂ ਸਭ ਨੇ ਰੱਜ ਕੇ ਰੋਟੀ ਖਾਦੀ ਮੈਨੂੰ ਇਹ ਪਕਵਾਨ ਬਣਾ ਕੇ ਬਹੁਤ ਖੁਸ਼ੀ ਹੋਈ ਕਿਉਂਕਿ ਇਸਦਾ ਟੇਸਟ ਦੂਜੀਆਂ ਸਬਜ਼ੀਆਂ ਨਾਲੋਂ ਬਿਲਕੁਲ ਵੱਖਰਾ ਸੀ